ਜਦੋਂ ਅਸੀਂ ਸਾ ਮੋਟਰਸਾਈਕਲ ਚਲਾਉਣ ਵੇਲੇ ਬਹੁਤ ਚੀਜ਼ਾਂ ਦਾ ਧਿਆਨ ਰੱਖਦੇ ਹਨ ਜਿਵੇਂ ਕਿ ਮੌਸਮ ਦੀ ਹਾਲਤ ਕਿਸ ਕੈਸੀ ਹੈ ਉਸ ਜਗ੍ਹਾ ਦੀ ਅਤੇ ਉਸ ਏਰੀਆ ਦਾ ਸੜਕ ਕੈਸ ਉਸ ਏਰੀਆ ਦੀ ਸੜਕ ਐਸੀ ਹੈ ਜਦੋਂ ਆਪਾਂ ਨੇ ਨਿਕਲਣਾ ਹੋਵੇ ਤਾਂ ਨਾਲ ਦੀ ਨਾਲ ਅਸੀਂ ਆਪਣੇ ਨਾਲ ਦੀ ਨਾਲ ਆਪਾਂ ਇੱਕ ਮੈਡੀਕਲ ਕਿੱਟ ਜਿਹੜੇ ਕਿ ਵੱਧ ਹਾਦਸੇ ਵੇਲੇ ਕੰਮ ਆਉਂਦੀ ਹੈ ਅਸੀਂ ਉਹ ਵੀ ਰੱਖਦੇ ਹਾਂ ਨਾਲ ਅਤੇ ਨਾਲ ਦੀ ਨਾਲ ਦੋ ਚਾਰ ਹੋਰ ਇੰਪੋਰਟੈਂਟ ਚੀਜ਼ਾਂ ਚੈੱਕ ਕਰ ਕੇ ਨਿਕਲਦੇ ਹੁੰਦੇ ਹਨ ਤੇ ਜਦੋਂ ਯਾਤਰਾ ਦੌਰਾਨ ਅਸੀਂ ਆਪਣੇ ਨਾਲ ਇੱਕ ਮੋਟਰਸਾਈਕਲ ਦੀ ਓਰੀਜਨਲ ਆਰ ਸੀ ਪਲਿਊਸ਼ਨ ਇਨ ਸ਼ੋਰੈਂਸ ਅਤੇ ਨਾਲ ਦੀ ਨਾਲ ਆਪਣਾ ਡਰਾਈਵਿੰਗ ਲਾਈਸੈਂਸ ਰੱਖਦੇ ਹਨ ਕਿਉਂਕਿ ਪੁਲਿਸ ਇਹੀ ਚੀਜ਼ਾਂ ਦੀ ਡਿਮਾਂਡ ਕਰਦੀ ਹਨ ਆਰ ਸੀ ਉਹ ਚੀਜ਼ ਹੈ ਜਿਹੜਾ ਆਪਣੇ ਮੋਟਰਸਾਈਕਲ ਦੇ ਬਾਰੇ ਔਨਲਾਈਨ ਸਰਕਾਰ ਨੂੰ ਛੜਾਉਂਦੀ ਹਨ ਅਤੇ ਇੱਕ ਵੈਲਿਡ ਡਰਾਈਵਿੰਗ ਲਾਈਸੈਂਸ ਹੈ ਜਿਹੜਾ ਆਪਣੇ ਮੋਟਰਸਾਈਕਲ ਨੂੰ ਸੜਕ ਉੱਤੇ ਚੱਲਣ ਦੇ ਲਈ ਮਦਦ ਕਰਦੀ ਹੈ ਅਤੇ ਇੰਸ਼ੋਰੈਂਸ ਉਹ ਹੈ ਕਿ ਜਿਹੜੀ ਆਪਣੀ ਵਹੀਕਲ ਦਾ ਬੀਮਾ ਹੁੰਦਾ ਹੈ ਜਿਸ ਦੇ ਨਾਲ ਆਪਾਂ ਨੂੰ ਆਪਣੇ ਵਹੀਕਲ ਦਾ ਪਤਾ ਲੱਗਦਾ ਹੈ ਜੇ ਕੋਈ ਹਾਦਸਾ ਹੁੰਦਾ ਹੈ ਤਾਂ ਉਹ ਰਿਪੇਅਰ ਕਰਾਉਣ ਵੇਲੇ ਇੰਸ਼ੋਰੈਂਸ ਹੀ ਆਪਣੀ ਮਦਦ ਕਰਦਾ ਹੈ ਉਸ ਇੰਸ਼ੋਰੈਂਸ ਦੇ ਨਾਲ ਕੀ ਹੈ ਕਿ ਆਪਣੇ ਜਿੰਨੇ ਵੀ ਪੈਸੇ ਹੁੰਦੇ ਹਨ ਉਹ ਸਾਰੇ ਇੰਸ਼ੋਰੈਂਸ ਕੰਪਨੀਆਂ ਵਾਲਿਆਂ ਨੂੰ ਦੇਣੇ ਪੈ ਜਾਂਦੇ ਹਨ ਅਤੇ ਨਾਲ ਦੀ ਨਾਲ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜਿਸ ਦੇ ਨਾਲ ਅਸੀਂ ਆਪਣੀ ਅਤੇ ਆਪਣੇ ਵਹੀਕਲ ਦੀ ਸੁਰੱਖਿਆ ਨਾਲ ਕਰ ਸਕਦੇ ਹਾਂ ਪ੍ਰਦੂਸ਼ਣ ਦਾ ਕੀ ਹੈ ਪ੍ਰਦੂਸ਼ਣ ਇੱਕ ਉਹ ਡਾਕੂਮੈਂਟ ਹੈ ਜਿਹੜਾ ਆਪਣੇ ਧੂੰਆਂ ਜਿਹੜਾ ਆਪਣਾ ਮੋ ਵਹੀਕਲ ਛੱਡਦਾ ਹੈ ਉਹ ਉਸ ਦਾ ਨਾਪ ਲੈ ਕੇ ਉਹ ਇੰਨਾ ਜ਼ਿਆਦਾ ਪ੍ਰਦੂਸ਼ਣ ਤਾਂ ਨਹੀਂ ਕਰ ਰਿਹਾ ਉਸ ਕਰਕੇ ਉਹ ਰੱਖਿਆ ਜਾਂਦਾ ਹੈ ਇਸ ਕਰਕੇ ਅਤੇ ਡਰਾਈਵਿੰਗ ਲਾਈਸੈਂਸ ਉਹ ਚੀਜ਼ ਹੈ ਜਿਹੜਾ ਬੰਦੇ ਦੇ ਬਾਰੇ ਦੱਸਦਾ ਹੈ ਕਿ ਬੰਦਾ ਬੰਦੇ ਨੂੰ ਗੱਡੀ ਚਲਾਉਣੀ ਆਉਂਦੀ ਹੈ ਜਾਂ ਮੋਟਰਸਾਈਕਲ ਚਲਾਉਣੀ ਆਉਂਦੀ ਹੈ ਕਿ ਨਹੀਂ ਇਹ ਚੀਜ਼ਾਂ ਦੱਸਦੀਆਂ ਹਨ ਕਿ ਬੰਦਾ ਇਹ ਚੀਜ਼ਾਂ ਦੱਸਦੀਆਂ ਹਨ ਕਿ ਕੀ ਬੰਦਾ ਡਰਾਇਵਰੀ ਵਾਲਾ ਹੈ ਜਾਂ ਪ੍ਰੋਫੈਸ਼ਨਲ ਡਰਾਈਵਰ ਹੈ ਜਾਂ ਉਹ ਆਪਣੇ ਵਹੀਕਲ ਦੇ ਬਾਰੇ ਹਰ ਚੀਜ਼ ਦੀ ਸੁਰੱਖਿਆ ਰੱਖਦਾ ਹੈ ਅੱਜ ਦੇ ਟਾਈਮ ਦੇ ਵਿੱਚ ਲੋਕ ਔਨਲਾਈਨ ਹੀ ਆਪਣੇ ਡਾਕੂਮੈਂਟ ਸਾਰੇ ਰੱਖਦੇ ਹਨ ਜਿਵੇਂ ਕਿ ਡੀਜੀਲੋਕਰ ਐਪ ਹੈ ਜਿਸ ਦੀ ਹੈਲਪ ਜਿਸ ਦੀ ਮਦਦ ਦੇ ਰਾਹੀਂ ਲੋਕ ਆਪਣੇ ਸਾਰੇ ਡਾਕੂਮੈਂਟ ਔਨਲਾਈਨ ਚੜਾ ਕੇ ਰੱਖਦੇ ਹਨ ਜਿਵੇਂ ਜਿਵੇਂ ਆਪਣਾ ਦੇਸ਼ ਬਦਲ ਰਿਹਾ ਹੈ ਉਵੇਂ ਉਵੇਂ ਲੋਕ ਹੀ ਆਪਣੇ ਆਪ ਨੂੰ ਬਦਲ ਰਹੇ ਹਨ ਜਿਵੇਂ ਲੋਕ ਸਾਰੇ ਫਿਜ਼ੀਕਲ ਕਾਪੀਆਂ ਤੋਂ ਆ ਕੇ ਔਨਲਾਈਨ ਡਿਜ਼ੀਟਲ ਕਾਪੀਆਂ ਰੱਖਣ ਲੱਗ ਗਏ ਹਨ ਜੇ ਉਸ ਦੇ ਕਾਰਨ ਹੀ ਲੋਕਾਂ ਨੇ ਆਪਣੇ ਆਪ 'ਚ ਵੀ ਬਦਲਾਵ ਲਿਆਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਹੌਲੀ ਹੌਲੀ ਦੇਸ਼ ਆਪਣਾ ਵਿਕਸਿਤ ਹੋ ਰਿਹਾ ਹੈ ਅਤੇ ਪੰਜਾਬ ਵੀ ਵਿਕਸਿਤ ਹੋ ਰਿਹਾ ਹੈ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਪੁਲਿਸ ਵਾਲਿਆਂ ਨੇ ਚੱਲਦੇ ਚੱਲਦੇ ਹੀ ਲੋਕਾਂ ਨੂੰ ਗਾਈਡ ਕਰ ਦੇਣਾ ਹੈ ਜੇ ਕੋਈ ਗਲਤ ਰਾਹ 'ਤੇ ਚੱਲ ਰਿਹਾ ਹੈ ਉਸ ਦਾ ਉਸ ਨੂੰ ਸਜ਼ਾ ਦੇ ਕੇ ਉਸ ਨੂੰ ਅੱਗੇ ਸਹੀ ਰਾਹ 'ਤੇ ਤੌਰ ਦੇਣਾ ਸ਼ੁਰੂ ਕਰ ਦੇਣਾ ਹੈ ਅਤੇ ਇਸ ਦੇ ਇਸ ਦੇ ਨਾਲ ਹੀ ਲੋਕਾਂ ਨੇ ਆਪਣੇ ਰਸਤੇ ਸਿੱਧੇ ਪਾ ਲਏ ਹਨ ਅਤੇ ਜਿਵੇਂ ਜਿਵੇਂ ਦੇਸ਼ ਵੱਧਦਾ ਹੈ ਉਵੇਂ ਉਵੇਂ ਪੰਜਾਬ ਵੀ ਵੱਧਦਾ ਜਾਵੇਗਾ